ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਮੁਕਤਸਰ ਸਾਹਿਬ ਤੋਂ ਬੋਲਦੇ ਆ ਹਾਂਜੀ ਅਸੀਂ ਨਾ ਮੀਡੀਆ ਤੋਂ ਬੋਲਦੇ ਹਾਂ ਅਸੀਂ ਤੁਹਾਡੇ ਮੁਕਤਸਰ ਸਾਹਿਬ ਬਾਰੇ ਪੁੱਛਣਾ ਸੀਗਾ ਵੀ ਇੱਥੇ ਕਿਵੇਂ ਕਿਵੇਂ ਸਾਰੇ ਤਿਉਹਾਰ ਕਿਵੇਂ ਮਨਾਏ ਜਾਂਦੇ ਕਿਹੜੇ ਕਿਹੜੇ ਇਤਿਹਾਸਿਕ ਥਾਂ ਹੈਗੇ ਆ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਕਿਹੜਾ ਕਿਹੜਾ ਹੈਗਾ ਇੱਥੇ ਗੁਰਦੁਆਰਾ ਸਾਹਿਬ ਬਾਰੇ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓਂਗੇ ਹਾਂਜੀ ਹਾਂਜੀ

ਹਾਂਜੀ

ਹਾਂਜੀ

ਠੀਕ ਹਾਂਜੀ ਠੀਕ ਹੈ ਹਾਂ ਹਾਂਜੀ ਹਾਂਜੀ ਅਸੀਂ ਇੱਥੇ ਸੁਣਿਆ ਇੱਥੇ ਇਕ ਮੁਸਲਮਾਨ ਦੀ ਵੀ ਜਗ੍ਹਾ ਬਣੀ ਹੈ ਜਿਹਦੇ ਛਿੱਤਰ ਮਾਰਦੇ ਆ

ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਓਕੇ ਜੀ